ਅਥਲੀਟਾਂ ਨੂੰ ਸਿਖਲਾਈ ਦੇਣ ਲਈ ਸਾਡੇ ਖੇਤਰ ਵੱਲ ਬਹੁਤ ਸਾਰੇ ਜ਼ਿਆਦਾ ਸ ਕੇਂਦਰ ਹਨ ਜਿਸ ਵਿੱਚ ਖੇਡ ਕੇਂਦਰ ਹਨ ਜਿਸ ਵਿੱਚ ਸਪੋਰਟ ਕਲੱਬ ਸ਼ਿਵਾਲਿਕ ਪਲੋਟ ਕਲੱਬ ਹੈ ਜੋ ਪ੍ਰਾਈਵੇਟ ਹੈ ਜੇ ਇਸ ਇੱਥੇ ਭਗਤ ਸਿੰਘ ਸਪੋਰਟ ਕਲੱਬ ਹੈ ਜੋ ਜੀ ਬਹੁਤ ਹੀ ਸਾਇੰਸ ਸੈਂਟਰ ਕੋਲ ਹੈ ਇਹੋ ਜਿਹੇ ਬਹੁਤ ਸਾਰੇ ਸਪੋਰਟਸ ਕਲੱਬ ਹਨ ਜਿਸ ਨੇ ਸਾਡੇ ਪੰਜਾਬ ਨੂੰ ਖੇਡ ਕੇਂਦਰ ਵਿੱਚ ਬਹੁਤ ਜ਼ਿਆਦਾ ਸਾਨੂੰ ਸਿਖਲਾਈ ਦੇਣ ਲਈ ਬਹੁਤ ਜ਼ਿਆਦਾ ਸਹੂਲਤਾਂ ਕੀਤੀਆਂ ਉਪਲੱਬਧ ਕੀਤੀਆਂ ਹਨ ਇਹ ਸਪੋ ਇਹ ਸਪੋਰਟਸ ਕਲੱਬ ਕਈ ਸਪੋਰਟਸ ਕਲੱਬ ਸਰਕਾਰੀ ਹਨ ਕਈ ਪ੍ਰਾਈਵੇਟ ਵੀ ਹਨ ਜਿਨ੍ਹਾਂ ਪ੍ਰਾਈਵੇਟ ਵਿੱਚ ਸਹੂਲਤਾਂ ਬਹੁਤ ਜ਼ਿਆਦਾ ਹਨ ਪਰ ਸਰਕਾਰੀ ਵਿੱਚ ਸਹੂਲਤਾਂ ਥੋੜ੍ਹੀਆਂ ਘੱਟ ਹਨ ਜਿਸ ਕਾਰਨ ਲੋਕ ਪ੍ਰਾਈਵੇਟ ਵਿੱਚ ਬਹੁਤ ਜ਼ਿਆਦਾ ਜਾਂਦੇ ਹਨ ਸਰਕਾਰੀ ਵਿੱਚ ਸਹੂਲਤਾਂ ਘੱਟ ਹੋਣ ਕਾਰਨ ਲੋਕ ਪ੍ਰਾਈਵੇਟ ਵੱਲ ਜ਼ਿਆਦਾ ਪ੍ਰੈਫਰ ਕਰਦੇ ਹਨ ਜਿਸ ਕਾਰਨ ਸਾਨੂੰ ਆਪਣੀ ਸਾਨੂੰ ਆਪਣੇ ਸਾਰਿਆਂ ਨੂੰ ਸਰਕਾ ਸਰਕਾਰੀਆਂ ਵਿੱਚ ਵੀ ਸਾਨੂੰ ਆਪਣੀ ਉਹ ਹੀ ਸਹੂਲਤਾਂ ਲਿਆਉਣੀਆਂ ਚਾਹੀਦੀਆਂ ਹਨ ਜਿਸ ਕਾਰਨ ਕਿ ਲੋਕ ਪ੍ਰਾਈਵੇਟ ਸੈਕਟਰ ਵੱਲ ਨਾ ਜਾਣ ਸਹੂਲਤਾਂ ਵਿੱਚ ਕੇਂਦਰ ਵੱਲ ਨਾ ਜਾਣ ਅਤੇ ਸਰਕਾਰੀ ਵਿੱਚ ਵੀ ਉਹ ਹੀ ਸਹੂਲਤਾਂ ਮਿਲਣ ਪਰ ਸਾਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਸਾਨੂੰ ਅਥਲੀਟਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਗਈਆਂ ਹਨ ਜਿਸ ਕਾਰਨ ਸਾਡੇ ਦੇ ਪੰਜਾਬ ਵਿੱਚ ਬਹੁਤ ਕਪੂਰਥਲੇ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਸਪੋਰਟਸ ਵਧੀਆ ਖੇਡੀ ਜਾਂਦੀ ਹੈ ਅਤੇ ਸਪੋਰਟਸ ਨੂੰ ਬਹੁਤ ਜ਼ਿਆਦਾ ਮਾਨਤਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਸ ਅੱਧ ਤੋਂ ਜ਼ਿਆਦਾ ਲੋਕ ਜ਼ਿਆਦਾ ਬੱਚੇ ਯੂਥ ਸਪੋਰਟਸ ਵੱਲ ਹੀ ਜਾਂਦੇ ਹੈ ਕਿਉਂਕਿ ਉੱਥੇ ਬਹੁਤ ਜ਼ਿਆਦਾ ਸਭ ਖੇਡ ਕੇਂਦਰ ਵੀ ਹਨ ਅਤੇ ਉਹਨਾਂ ਨੂੰ ਖੇਡ ਵੱਲ ਪ੍ਰੇਰਿਤ ਵੀ ਕੀਤਾ ਜਾਂਦਾ ਹੈ ਇਸ ਲਈ ਸ ਸਾਨੂੰ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਕਿ ਇਹ ਸਾਡੇ ਉੱਥੇ ਸਪੋਰਟਸ ਬੱਚੇ ਸਾਰੇ ਸਿਖਲਾਈ ਕੇਂਦਰ ਵਿੱਚ ਜਾਂਦੇ ਹਨ ਖੇਡ ਕੇਂਦਰ 'ਚ ਜਾਂਦੇ ਹਨ